ਨਹੀਂ ਵੈਸੇ ਤਾਂ ਮੇਰੇ ਕੋਈ ਰੋਲ ਮੋਡਲ ਜਾਂ ਫਿਰ ਕੋਈ ਵੀ ਮੇਰੇ ਸਲਾਹਕਾਰ ਐਵੇਂ ਦੇ ਕੋਈ ਮਾਰਸ਼ਲ ਆਰਟ ਦੇ ਵਿੱਚ ਨਹੀਂ ਮੇਰੇ ਕੋਲ ਮਾਰਸ਼ਲ ਆਟਸ ਨਹੀਂ ਹੈ ਪਰ ਅੱਜ ਕੱਲ੍ਹ ਟਾਈਮ ਹੀ ਐਸਾ ਚੱਲ ਰਿਹਾ ਹੈ ਕਿ ਮੈਨੂੰ ਐਵੇਂ ਲੱਗਦਾ ਹੈ ਕਿ ਮਾਰਸ਼ਲ ਆਰਟ ਹਰ ਇੱਕ ਸਕੂਲ ਦੇ ਵਿੱਚ ਹਰ ਇੱਕ ਕੋਈ ਵੀ ਇੰਸਟੀਟਿਊਸ਼ਨ ਹੈ ਉੱਥੇ ਅਵੇਲੇਵਲ ਹੋਣਾ ਚਾਹੀਦਾ ਉੱਥੇ ਜ਼ਰੂਰੀ ਹੀ ਇੱਕ ਸਬਜੈਕਟ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਕੁੜੀਆਂ ਉਹ ਕਿਸੇ ਵੀ ਜਗ੍ਹਾ 'ਤੇ ਸੇਫ ਹੈ ਹੀ ਨਹੀਂ ਅੱਜ ਕੱਲ੍ਹ ਕਿੰਨੇ ਰੇਪ ਕੇਸ ਕਿੰਨੇ ਜ਼ਿਆਦਾ ਵੱਧ ਰਹੇ ਹੈ ਤਾਂ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਮਾਰਸ਼ਲ ਆਰਟ ਦੀ ਸਕਿੱਲ ਜੇ ਕਿਸ ਕੁੜੀਆਂ ਨੂੰ ਆਉਂਦੀ ਹੋਵੇਗੀ ਮਤਲਬ ਜੇ ਉਨ੍ਹਾਂ ਨੇ ਉਨ੍ਹਾਂ ਕੋਲ ਸਕਿੱਲ ਹੋਵੇਗੀ ਤਾਂ ਉਹ ਆਪ ਦੀ ਸੁਰੱਖਿਆ ਜਿਹੜੀ ਉਹ ਆਪ ਕਰ ਸਕਦੀਆਂ ਅਤੇ ਇਹ ਜ਼ਰੂਰੀ ਹੈ ਕਿ ਇਹ ਇੱਕ ਅਲੱਗ ਤੋਂ ਅੱਜ ਕੱਲ੍ਹ ਤਾਂ ਵੈਸੇ ਸਕੂਲਾਂ ਦੇ ਵਿੱਚ ਇਹ ਕੋਈ ਸਬਜੈਕਟ ਹੈ ਨਹੀਂ ਗਾ ਇਹਦਾ ਇੰਨਾ ਬੋਲਬਾਲਾ ਹੈ ਨਹੀਂ ਗਾ ਆਪਣੇ ਇੱਧਰਲੇ ਏਰੀਏ ਮਤਲਬ ਪੰਜਾਬ ਸਾਈਡ ਇੱਧਰ ਜਾਂ ਫਿਰ ਹਰਿਆਣਾ ਸਾਈਡ ਇੱਧਰਲੇ ਏਰੀਏ ਦੇ ਵਿੱਚ ਟਾਵੇਂ ਟਾਵੇਂ ਸਕੂਲਾਂ ਦੇ ਵਿੱਚ ਇਹ ਮਾਰਸ਼ਲ ਆਰਟ ਦਾ ਜਿਹੜਾ ਸਬਜੈਕਟ ਹੈਗਾ ਅਤੇ ਪਰ ਮੈਨ ਮੈਨੂੰ ਐਵੇਂ ਲੱਗਦਾ ਕਿ ਜਿਹੜਾ ਇਹ ਸਬਜੈਕਟ ਹੈ ਇਹ ਜ਼ਰੂਰੀ ਤੌਰ 'ਤੇ ਪੱਕੇ ਤੌਰ 'ਤੇ ਤੌਰ 'ਤੇ ਜਿਹੜਾ ਇਹ ਸਬਜੈਕਟ ਹੈ ਉਹ ਸਕੂਲਾਂ ਦੇ ਵਿੱਚ ਹੋਣਾ ਹੀ ਚਾਹੀਦਾ ਅਤੇ ਕੰਪਲਸਰੀ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਕੁੜੀਆਂ ਹੈ ਜੇ ਇਹ ਸਕਿੱਲ ਲੈਣਗੀਆਂ ਸਿੱਖਣਗੀਆਂ ਤਾਂ ਆਪਣੀ ਸੁਰੱਖਿਆ ਉਹ ਕਰ ਸਕਦੀਆਂ ਉਨ੍ਹਾਂ ਨੂੰ ਐਵੇਂ ਦੀ ਕੋਈ ਵੀ ਦਿੱਕਤ ਜਾਂ ਪ੍ਰੇਸ਼ਾਨੀ ਕੋਈ ਵੀ ਛੇੜਖਾਨੀ ਵਾਲਾ ਜਾਂ ਫਿਰ ਕੋਈ ਵੀ ਐਵੇਂ ਦੀ ਅੱ ਜਿਵੇਂ ਦੀਆਂ ਅੱਜ ਕੱਲ੍ਹ ਪ੍ਰੇਸ਼ਾਨੀਆਂ ਨਾਲ ਜੂਝਣਾ ਪੈ ਰਿਹਾ ਹੈ ਐਵੇਂ ਦੀ ਸ਼ਾਇਦ ਉਨ੍ਹਾਂ ਨੂੰ ਫਿਊਚਰ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ ਜੇਕਰ ਉਨ੍ਹਾਂ ਕੋਲ ਇਹ ਸਕਿੱਲ ਹੋਵੇਗੀ ਤਾਂ ਤਾਂ ਇਸ ਸਕਿੱਲ ਨੂੰ ਪੱਕੇ ਤੌਰ 'ਤੇ ਸਕੂਲਾਂ ਦੇ ਵਿੱਚ ਹੋਣਾ ਚਾਹੀਦਾ ਹਰੇਕ ਇੰਸਟੀਟਿਊਸ਼ਨ ਦੇ ਵਿੱਚ ਹੋਣਾ ਚਾਹੀਦਾ ਅਤੇ ਕੰਪਲਸਰੀ ਸਬਜੈਕਟ ਲਗਵਾਉਣਾ ਚਾਹੀਦਾ ਸਰਕਾਰ ਨੂੰ ਇਸ ਵੱਲ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ ਅਤੇ ਮਾਰਸ਼ਲ ਆਟਸ ਦੇ ਵਿੱਚ ਜੇਕਰ ਸਾਡੇ ਸਾਡੇ ਸਕੂਲ ਦੇ ਵਿੱਚ ਤਾਂ ਇਹ ਸਬਜੈਕਟ ਹੈ ਨਹੀਂ ਸੀਗਾ ਬੱਟ ਜੇ ਸਾਡੇ ਸਕੂਲ ਦੇ ਵਿੱਚ ਇਹ ਮਾਰਸ਼ਲ ਆਟਸ ਵਿੱਚ ਦਾ ਕੋਈ ਵੀ ਸਬਜੈਕਟ ਹੁੰਦਾ ਤਾਂ ਮੈਂ ਡੈਫੀਨੇਟਲੀ ਇਹ ਸਬਜੈਕਟ ਰੱਖਦੀ ਅਤੇ ਇਹਦੇ ਵਿੱਚ ਮੈਂ ਮੇਰਾ ਰੋਲ ਮੋਡਲ ਸੁਰੀਤਾ ਨੂੰ ਲੈ ਸਕਦੀ ਹਾਂ ਕਿਉਂਕਿ ਉਹ ਮੇਰੇ ਟੀਚਰ ਰਹੇ ਟੀਚਰ ਹੁਣ ਅ ਸਕੂਲ 'ਚ ਤਾਂ ਨਹੀਂ ਰਹੇ ਪਰ ਉਸ ਤੋਂ ਅੱਗੇ ਇੰਸਟੀਟਿਊਸ਼ਨ ਦੇ ਵਿੱਚ ਮੈਨੂੰ ਮਿਲੇ ਅਤੇ ਮੈਂ ਇੱਕ ਇਹ ਇਹ ਸਕਿੱਲ ਅਲੱਗ ਤੋਂ ਲਿੱਤੀ ਹੈਗੀ ਹੈ